ਹਾਂਜੀ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਜਿਸ ਕਾਰਨ ਸਾਡੇ ਪੰਜਾਬ ਦੇ ਹਰ ਇੱਕ ਵਾਸੀ ਨੂੰ ਪੰਜਾਬੀ ਭਾਸ਼ਾ ਆਉਣੀ ਬਹੁਤ ਜ਼ਰੂਰੀ ਕਿਉਂਕਿ ਇਹ ਸਾਡੀ ਮਾਂ ਬੋਲੀ ਹੈ ਔਰ ਮਾਂ ਬੋਲੀ ਹਰ ਇੱਕ ਪ੍ਰਾਂਤ ਨੂੰ ਹ ਹਰ ਇੱਕ ਪ੍ਰਾਂਤ ਦੇ ਵਾਸੀਆਂ ਨੂੰ ਆਉਣੀ ਚਾਹੀਦੀ ਹੈ ਲੇਕਿਨ ਪੰਜਾਬੀ ਜਿੱਦਾਂ ਅਸੀਂ ਅੰਮ੍ਰਿਤਸਰ ਦੇ ਦੇ ਵਾਸੀ ਹਾਂ ਅੰਮ੍ਰਿਤਸਰ ਇੱਕ ਟੂਰਿਸਟ ਪਲੇਸ ਹੈ ਇਥੇ ਲੱਖਾਂ ਦੀ ਗਿਣਤੀ ਵਿੱਚ ਟੂਰਿਸਟ ਆਉਂਦਾ ਹੈ ਦਰਬਾਰ ਸਾਹਿਬ ਮੱਥਾ ਟੇਕਣ ਕੋਈ ਕਿਹੜੇ ਪ੍ਰਾਂਤ ਤੋਂ ਕੋਈ ਕਿਹੜੇ ਪ੍ਰਾਂਤ ਤੋਂ ਤੋਂ ਕੋਈ ਕਿਤੇ ਕੋਈ ਕਿਤੋਂ ਆਉਂਦਾ ਹੈ ਇਸ ਕਰਕੇ ਹਰ ਇੱਕ ਨੂੰ ਦੇਖੋ ਆਪਣੀ ਮਾਂ ਬੋਲੀ ਨਹੀਂ ਆਉਂਦੀ ਹਰ ਇੱਕ ਪ੍ਰਾਂਤ ਨੂੰ ਆਪਣੀ ਮਾਂ ਬੋਲੀ ਆਉਂਦੀ ਹੈ ਜਿੱਦਾਂ ਕੋਈ ਗੁਜਰਾਤੀ ਹੈ ਤਾਂ ਉਹਨੂੰ ਗੁਜਰਾਤੀ 'ਚ ਆਏਗੀ ਕੋਈ ਹਰਿਆਣੇ ਦਾ ਆਉਂਦਾ ਉਹਨੂੰ ਹਰਿਆਣਵੀ ਆਉਂਦੀ ਹੈ ਪਰ ਸਾਡੀ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਸਾਡੇ ਹੀ ਖੇਤਰ ਦੇ ਵਿੱਚ ਚੱਲਦੀ ਹੈ ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਹਿੰਦੀ ਅਤੇ ਇੰਗਲਿਸ਼ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਦੂਰੋਂ ਦੂਰੋਂ ਟੂਰਿਸਟ ਘੁੰਮਣ ਆਉਂਦੇ ਆ ਤਾਂ ਉਹਨਾਂ ਨੂੰ ਹਰ ਇੱਕ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਅਤੇ ਉਹਨਾਂ ਨੂੰ ਪੰਜਾਬੀ 'ਚ ਨਹੀਂ ਅਸੀਂ ਸਮਝਾ ਸਕਦੇ ਕਿਉਂਕਿ ਸਾਡੀ ਰਾਸ਼ਟਰ ਭਾਸ਼ਾ ਹਿੰਦੀ ਹੈ ਅਤੇ ਸਾਨੂੰ ਉਹਨਾਂ ਨੂੰ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਸਮਝਾਉਣਾ ਪੈਂਦਾ ਹੈ ਬਾਕੀ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਾਡੇ ਬੱਚਿਆਂ ਨੂੰ ਜਿਹੜੇ ਅਸੀਂ ਪੰਜਾਬ ਦੇ ਵਾਸੀ ਹਾਂ ਉਹਨਾਂ ਨੂੰ ਆਪਣੀ ਮਾਂ ਬੋਲੀ ਆਉਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਪੰਜਾਬੀ ਭਾਸ਼ਾ ਨੂੰ ਨਹੀਂ ਸਿੱਖਾਂਗੇ ਤਾਂ ਪੰਜਾਬ ਦੇ ਵਿੱਚ ਰਹਿ ਕੇ ਸਾਡੇ ਆਉਣ ਵਾਲੀ ਯੁਵਾ ਪੀੜੀ ਪੰਜਾਬ ਦੇ ਵਿੱਚ ਗੌਰਮੈਂਟ ਜੋਬ ਕਰਨ ਦੀ ਹੱਕਦਾਰ ਨਹੀਂ ਹੈ ਕਿਉਂਕਿ ਜਿਹੜਾ ਪੰਜਾਬ ਦਾ ਵਾਸੀ ਹੋਏਗਾ ਉਹਨੂੰ ਸਰਕਾਰੀ ਨੌਕਰੀ ਕਰਨ ਵਾਸਤੇ ਪੰਜਾਬੀ ਭਾਸ਼ਾ ਆਉਣਾ ਜ਼ਰੂਰੀ ਹੈ ਸੋ ਇਸ ਕਰਕੇ ਪੰਜਾਬੀ ਭਾਸ਼ਾ ਹੋਰ ਭਾਸ਼ਾਵਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਕਿਉਂਕਿ ਇਸ ਦੇ ਨਾਲ ਨਾਲ ਸਾਨੂੰ ਆਪਣੀ ਰਾਸ਼ਟਰ ਭਾਸ਼ਾ ਵੀ ਆਉਣੀ ਚਾਹੀਦੀ ਹੈ ਅਤੇ ਸਾਨੂੰ ਆਪਣੀ ਇੰਟਰਨੈਸ਼ਨਲ ਲੈਂਗੁਏਜ ਵੀ ਆਉਣੀ ਚਾਹੀਦੀ ਹੈ ਕਿਉਂਕਿ ਹਰ ਕੋਈ ਪੰਜਾਬੀ ਭਾਸ਼ਾ ਨੂੰ ਸਮਝ ਨਹੀਂ ਸਕਦਾ ਬਾਕੀ ਆਪਣੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ ਪੰਜਾਬ 'ਚ ਰਹਿੰਦੇ ਹਾਂ ਪੰਜਾਬੀ ਭਾਸ਼ਾ ਨੂੰ ਅੱਗੇ ਲਿਆਉ ਪੰਜਾਬ 'ਚ ਰਹਿ ਕੇ ਔਰ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਬੋਲੀ ਦਾ ਸਤਿਕਾਰ ਕਰਕੇ ਭਾਸ਼ਾ ਦਾ ਸਤਿਕਾਰ ਕਰਕੇ ਇਹਦਾ ਆਦਰ ਸਨਮਾਨ ਕਰੋ